ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਕੰਪਨੀਆਂ ਦੀਆਂ ਸਿੰਮਾਂ ਹਨ ਜੋ ਕਿ ਉਹਨਾਂ ਵਿੱਚ ਆਉਂਦੀਆਂ ਹਨ ਏਅਰਟੈੱਲ ਜੀਓ ਅਤੇ ਵੀ ਆਈ ਵੋਡਾਫੋਨ ਰਿਲਾਇਨਸ ਆਈਡੀਆ ਸਭ ਤੋਂ ਜ਼ਿਆਦਾ ਵਧੀਆ ਨੈਟਵਰਕ ਹੈ ਆਈਡੀਆ ਦਾ ਜੋ ਕਿ ਮੈਨੂੰ ਬਹੁਤ ਪਸੰਦ ਹੈ ਸਦ ਸਾਡੇ ਖੇਤਰ ਵਿੱਚ ਆਈਡੀਆ ਅਤੇ ਜੀਓ ਬਹੁਤ ਵਧੀਆ ਚੱਲਦੀਆਂ ਹਨ ਅਤੇ ਇੰਟਰਨੈਸ਼ਨਲ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਪਨੀਆਂ ਹਨ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਅੱਡ ਅੱਡ ਵੱਖ ਵੱਖ ਨਾਮਾਂ ਦੀਆਂ ਸਿੰਮਾਂ ਹਨ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਚੱਲਣ ਵਾਲਾ ਨੈਟਵਰਕ ਜੀਓ ਹੈ ਜੋ ਕਿ ਮੁਕੇਸ਼ ਅੰਬਾਨੀ ਵੱਲੋਂ ਬਣਾਇਆ ਗਿਆ ਹੈ ਮੈਨੂੰ ਬਹੁਤ ਪਸੰਦ ਹੈ ਜੀਓ ਦਾ ਨੈਟਵਰਕ ਨੈਟਵਰਕ ਮੈਂ ਬਹੁਤ ਯੂਜ ਕਰਦਾ ਹਾਂ ਸਾਡੇ ਖੇਤਰ ਖੇਤਰ ਵਿੱਚ ਇਸ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਜੀਓ ਨੈਟਵਰਕ ਬਹੁਤ ਚੰਗਾ ਨੈਟਵਰਕ ਹੈ ਇਸ ਨੂੰ ਮੈਂ ਬਹੁਤ ਜ਼ਿਆਦਾ ਯੂਜ ਕਰਦਾ ਹਾਂ ਇਹ ਪਹਿਲਾਂ ਮੁਕੇਸ਼ ਅੰਬਾਨੀ ਵੱਲੋਂ ਬਹੁਤ ਸਸਤੇ ਰੀਚਾਰਜ ਕੀਤੇ ਗਏ ਸੀ ਸਨ ਤਿੰਨ ਚਾਰ ਸਾਲ ਬਾਅਦ ਹੁਣ ਇਹਨਾਂ ਨੇ ਬਹੁਤ ਜ਼ਿਆਦਾ ਮਹਿੰਗੇ ਰੀਚਾਰਜ ਕਰਤੇ ਆਈ ਏਅਰਟੈੱਲ ਵੱਲੋਂ ਵੀ ਬਹੁਤ ਇਹਨਾਂ ਨੇ ਰੀ ਰੀਚਾਰਜ ਮਹਿੰਗੇ ਕੀਤੇ ਹੋਏ ਸਨ ਏਅਰਟੈਲ ਵੀ ਬਹੁਤ ਜ਼ਿਆਦਾ ਵਧੀਆ ਕੰਪਨੀ ਹੈ ਕਿਉਂਕਿ ਸਾਡੇ ਇੱਥੇ ਇਹਦਾ ਵੀ ਨੈਟਵਰਕ ਬਹੁਤ ਵਧੀਆ ਆਉਂਦਾ ਹੈ ਪਹਿਲਾਂ ਅਸੀਂ ਸਾਡੇ ਕੋਲ ਫੋਰ ਜੀ ਚੱਲਦਾ ਹੁੰਦਾ ਸੀ ਜਦੋਂ ਨੇ ਏਅਰਟੈਲ ਫਾਈਵ ਜੀ ਕੱਢਿਆ ਬਹੁਤ ਜ਼ਿਆਦਾ ਅੱਛੀ ਰੇਂਜ ਆ ਰਹੀ ਹੈ ਮੈਂ ਬਹੁਤ ਪ ਪਸੰਦ ਕਰਦਾ ਹਾਂ ਏਅਰਟੈਲ ਨੂੰ ਵੀ ਏਅਰਟੈਲ ਬਹੁਤ ਜ਼ਿਆਦਾ ਵਧੀਆ ਕੰਪਨੀ ਹੈ ਜੀਓ ਵੀ ਬਹੁਤ ਜ਼ਿਆਦਾ ਇੱਕ ਵਧੀਆ ਕੰਪਨੀ ਹੈ ਅਤੇ ਵੋਡਾਫੋਨ ਅਤੇ ਆਈਡੀਆ ਨੂੰ ਮਿਲਾ ਕੇ ਇਹਨਾਂ ਨੇ ਵੀ ਆਈ ਦਾ ਸਿੰਮ ਬਣਾਇਆ ਸੀਗਾ ਜੋ ਕਿ ਦੋਨੇ ਕੰਪਨੀਆਂ ਇਕੱਠੀਆਂ ਹੋ ਗਈਆਂ ਸੀਗੀਆਂ ਇਹ ਹੁਣ ਵੀ ਆਈ ਦੇ ਨਾਮ 'ਤੇ ਮਸ਼ਹੂਰ ਹਨ